ਮੇਰੇ ਮੰਮੀ ਹਮੇਸ਼ਾਂ ਕਹਿੰਦੇ ਆ ਕਿ ਖੁਸ਼ੀਆਂ ਨੂੰ ਮਨਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਣਾ ਚਾਹੀਦਾ ਏ ਇਸ ਕਰਕੇ ਅਸੀਂ ਹਰ ਇੱਕ ਦਿਨ ਨੂੰ ਖਾਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਮੈਂ ਜਿਹੜੇ ਸਾਡੇ ਘਰ ਪਾਰਟੀ ਔਰਗਨਾਈਜ਼ ਕੀਤੀ ਜਾਂਦੀ ਆ ਜਿਵੇਂ ਮੇਰੇ ਬ੍ਰਦਰ ਦਾ ਬਰਡੇ ਹੋਵੇ ਸਾਡੇ ਘਰ ਦੇ ਵਿੱਚ ਕਿਸੇ ਵੀ ਕਿਸੇ ਵੀ ਮੈਂਬਰ ਦਾ ਬਰਡੇ ਹੋਵੇ ਜਾਂ ਮੇਰੀ ਮੰਮੀ ਦੀ ਐਨੀਵਰਸਰੀ ਹੋਵੇ ਤਾਂ ਉਸ ਚੀਜ਼ ਨੂੰ ਮੈਂ ਔਰਗਨਾਈਜ਼ ਕਰਦੀ ਹਾਂ ਅਤੇ ਪਾਰਟੀ ਦਾ ਅਰੇਂਜਮੈਂਟ ਕਰਦੀ ਹਾਂ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਆ ਅਸੀਂ ਸਾਰੇ ਬਹੁਤ ਖੁਸ਼ ਹੁੰਦੇ ਹਾਂ ਅਤੇ ਸਾ ਅਸੀਂ ਆਪਣੇ ਜਿਵੇਂ ਥੋੜ੍ਹੇ ਬਹੁਤ ਰਿਸ਼ਤੇਦਾਰਾਂ ਨੂੰ ਬੁਲਾਨੇ ਹਾਂ ਅਤੇ ਓ ਉਦੋਂ ਮੇਰੇ ਫਰੈਂਡਸ ਮੇਰੇ ਮੰਮੀ ਦੀਆਂ ਸਹੇਲੀਆਂ ਸਾਰੀਆਂ ਇਕੱਠੀਆਂ ਹੋ ਕੇ ਹੈ ਨਾ ਅਸੀਂ ਪਾਰਟੀ ਪਾਰਟੀ ਕਰਦੇ ਹਾਂ ਅਤੇ ਅਸੀਂ ਬਹੁਤ ਇੰਜੋਏ ਕਰਦੇ ਹਾਂ ਅਤੇ ਉਸ ਚੀਜ਼ ਨੂੰ ਅਸੀਂ ਕੈਪਚਰ ਵੀ ਕਰਦੇ ਹਾਂ ਫੋਟੋਜ਼ ਕਲਿੱਕ ਕਰਦੇ ਹਾਂ ਅਤੇ ਡੀਜੇ ਨਾਲ ਅਸੀਂ ਨੱਚਦੇ ਹਾਂ ਬਹੁਤ ਜ਼ਿਆਦਾ ਸਾਨੂੰ ਵਧੀਆ ਲੱਗਦਾ ਆ